ਸਾਡੇ ਸੱਭਿਆਚਾਰ ਦੇ ਵਿੱਚ ਵਿਆਹ ਦੀ ਰਸਮ ਬਹੁਤ ਖੁਸ਼ੀਆਂ ਅਤੇ ਧੂਮ ਧਾਮ ਧੜੱਕੇ ਦੇ ਨਾਲ ਮਨਾਈ ਜਾਂਦੀ ਹੈ ਜਿਸ ਦੇ ਵਿੱਚ ਮੁੰਡੇ ਅਤੇ ਕੁੜੀ ਨੂੰ ਜਿਹੜਾ ਆਪਸ ਦੇ ਵਿੱਚ ਇੱਕ ਬੰਧਨ ਦੇ ਵਿੱਚ ਬੰਧਨ ਦੇ ਲਈ ਵਿਆਹ ਦੀ ਰਸਮ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਲੜਕੇ ਅਤੇ ਲੜਕੀ ਦੇ ਮਾਪੇ ਜਿਹੜੇ ਆਪਣੇ ਕਾਰਜ ਕਰਦੇ ਨੇ ਅਤੇ ਲੜਕਾ ਅਤੇ ਲੜਕੀ ਆਪਣੇ ਜੀਵਨ ਸਾਥੀ ਦੇ ਰੂਪ ਵਿੱਚ ਮਿਲ ਜਾਂਦੇ ਨੇ ਤਾਂ ਜੇ ਅਸੀਂ ਪੰਜਾਬੀ ਸੱਭਿਆਚਾਰ ਦੀ ਗੱਲ ਕੀਤੀ ਜਾਵੇ ਤਾਂ ਵਿਆਹ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੁੱਖ ਕੰਮ ਆਉਂਦਾ ਹੈ ਰੋਲ ਆਉਂਦਾ ਹੈ ਵੱਡੀ ਰਸਮ ਆਉਂਦੀ ਹੈ ਤਾਂ ਅਸੀਂ ਪੰਜਾਬ ਦੇ ਵਿੱਚ ਲਾਵਾਂ ਦੀ ਰਸਮ ਲੈਂਦੇ ਹਾਂ ਜਿਸ ਦੇ ਵਿੱਚ ਜਿਹੜਾ ਹੈ ਕੁੜੀ ਦਾ ਪਰਿਵਾਰ ਮੁੰਡੇ ਦਾ ਪਰਿਵਾਰ ਅਤੇ ਕੁੜੀ ਅਤੇ ਮੁੰਡਾ ਵਿਆਹ ਵਾਲੇ ਨੇ ਜੋ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਲਿਜਾ ਕੇ ਗੁਰੂ ਰਾਮਦਾਸ ਜੀ ਦੇ ਦੁਆਰਾ ਲਾਵਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ ਉਹ ਪੜ੍ਹੀਆਂ ਜਾਂਦੀਆਂ ਨੇ ਤਾਂ ਜੋ ਵਿਆਹ ਵਾਲਾ ਮੁੰਡਾ ਅਤੇ ਵਿਆਹ ਵਾਲੀ ਕੁੜੀ ਹੁੰਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਬੀੜ ਦੇ ਚੁ ਚੁਫੇਰੇ ਚੱਕਰ ਲਗਾਉਂਦੇ ਨੇ ਅਤੇ ਜਿਹੜਾ ਆਪਣੇ ਲਾਵਾਂ ਨੂੰ ਪੂਰਾ ਕਰਕੇ ਆਪਣੀ ਰਸਮ ਨੂੰ ਪੂਰਾ ਕਰਦੇ ਨੇ ਜਿਸ ਦੇ ਵਿੱਚ ਗੁਰੂ ਘਰ ਦਾ ਜੋ ਪਾਠੀ ਹੁੰਦਾ ਹੈ ਉਹ ਲਾਵਾਂ ਨੂੰ ਪੜ੍ਹਦਾ ਹੈ ਅਤੇ ਉਹ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਿੱਤਾ ਹੈ ਉਹਨਾਂ ਰਸਮਾਂ ਨੂੰ ਫੋਲੋ ਕਰਦੇ ਨੇ ਮੰਨਦੇ ਨੇ ਤਾਂ ਵਿਆਹ ਦੀ ਰਸਮ ਪੰਜਾਬ ਦੇ ਵਿੱਚ ਬੜੀ ਹੀ ਧੂਮਧਾਮ ਨਾਲ ਮਨਾਈ ਜਾਂਦੀ ਹੈ ਜੇਕਰ ਦੇਖਿਆ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਦੇਖਿਆ ਜਾਵੇ ਲੜਕੀ ਅਤੇ ਲੜਕੀ ਦੋਵਾਂ ਦੇ ਪਰਿਵਾਰਾਂ ਦੇ ਵਿੱਚ ਲਾੜੇ ਅਤੇ ਲਾੜੀ ਦੇ ਜਿਹੜਾ ਹੈ ਬਟਨਾ ਮਲਿਆ ਜਾਂਦਾ ਹੈ ਤਾਂ ਜੋ ਉਹ ਬਟਨਾ ਹੁੰਦਾ ਹੈ ਹਲਦੀ ਅਤੇ ਦੁੱਧ ਦਾ ਤਿਆਰ ਕੀਤਾ ਹੁੰਦਾ ਹੈ ਜਿਸ ਨਾਲ ਕਿ ਹੈ ਇੱਕ ਰਸਮ ਜਿਹੜੀ ਆਉਂਦੀ ਹੈ ਜਿਸ ਨਾਲ ਮੁੰਡੇ ਅਤੇ ਕੁੜੀ ਦਾ ਜਿਹੜਾ ਰੰਗ ਹੈ ਉਸ ਨੂੰ ਸਾਫ਼ ਕਰਨ ਦੇ ਵਿੱਚ ਕੰਮ ਆਉਂਦੀ ਹੈ ਤਾਂ ਅਜਿਹੀਆਂ ਬਹੁਤ ਰਸਮਾਂ ਨੇ ਜੋ ਵਿਆਹ ਦੇ ਵਿੱਚ ਕੀਤੀਆਂ ਜਾਂਦੀਆਂ ਹਨ